ਹੈਲੋ ਹਾਂਜੀ ਸਵੀਗੀ ਤੋਂ ਬੋਲਦੇ ਪਏ ਹੋ ਹਾਂਜੀ ਸਤਿ ਸ਼੍ਰੀ ਅਕਾਲ ਸਰ ਸਰ ਮੇਰਾ ਨਾ ਬੱਚੇ ਦਾ ਬਰਡੇ ਸੀਗਾ ਬੇਟੇ ਦਾ ਔਰ ਮੈਂ ਇੱਥੇ ਇੱਕ ਪਾਰਟੀ ਰੱਖੀ ਸੀਗੀ ਅਤੇ ਮੈਂ ਤੁਹਾਡੇ ਇੱਥੇ ਔਡਰ ਦਿੱਤਾ ਸੀਗਾ ਖਾਣੇ ਦਾ ਅਤੇ ਕੁਛ ਹੋਰ ਚੀਜ਼ਾਂ ਦਾ ਔਰ ਜਦੋਂ ਤੁਹਾਡਾ ਜਿਹੜਾ ਡਿਲੀਵਰੀ ਵਾਲਾ ਬੰਦਾ ਉਹ ਆਇਆ ਤਾਂ ਉਹਨੇ ਮੈਨੂੰ ਕੋਲ ਕੀਤੀ ਕਿ ਮੈਡਮ ਪਹਿਲੀ ਗੱਲ ਤਾਂ ਇਹ ਕਿ ਮੈਂ ਘਰ ਨਹੀਂ ਆ ਸਕਦਾ ਦੱਸੋ ਜੀ ਜਦੋਂ ਅਸੀਂ ਔਡਰ ਹੀ ਕਰ ਦਿੱਤਾ ਹੈ ਅਤੇ ਫਿਰ ਉਹ ਤਾਂ ਤੁਹਾਡੀ ਡਿਊਟੀ ਹੈ ਨਾ ਕਿ ਜਿਹੜੇ ਤੁਸੀਂ ਉੱਥੇ ਬੰਦੇ ਰੱਖੇ ਨੇ ਉਹਨਾਂ ਨੇ ਘਰ ਆ ਕੇ ਹੀ ਸਾਨੂੰ ਚੀਜ਼ਾਂ ਦੇਣੀਆਂ ਨੇ ਜੇ ਅਸੀਂ ਬਾਹਰ ਜਾਣਾ ਆ ਤਾਂ ਫਿਰ ਸਾਨੂੰ ਕੀ ਲੋੜ ਪਈ ਔਡਰ ਕਰਨ ਦੀ ਮੈਂ ਉਹਨੂੰ ਕਿਹਾ ਕਿ ਮੈਂ ਬਾਹਰ ਨਹੀਂ ਆ ਸਕਦੀ ਮੇਰੇ ਤਾਂ ਮਤਲਬ ਘਰ ਦੇ ਵਿੱਚ ਫੰਕਸ਼ਨ ਹੈ ਅਤੇ ਤੂੰ ਇੱਥੇ ਆ ਜਾ ਅਤੇ ਕੁਛ ਉਹਦਾ ਨਾ ਬੋਲਣ ਦਾ ਢੰਗ ਜਿਹੜਾ ਮੈਨੂੰ ਕੁਝ ਖਾਸ ਵਧੀਆ ਨਹੀਂ ਲੱਗਿਆ ਉਹ ਕੁਛ ਪਤਾ ਨਹੀਂ ਬੁੜ ਬੁੜ ਕਰਦਾ ਰਿਹਾ ਫਿਰ ਉਹਨੇ ਫੋਨ ਕੱਟ ਦਿੱਤਾ ਫਿਰ ਮੈਂ ਫੋਨ ਕੀਤਾ ਇਸ ਤਰ੍ਹਾਂ ਮੇਰੇ ਪੰਜ ਦਸ ਮਿੰਟ ਪਹਿਲਾਂ ਉਹਨੇ ਖਰਾਬ ਕੀਤੇ ਫਿਰ ਉਹ ਘਰ ਆਇਆ ਅਤੇ ਚਲੋ ਔਡਰ ਤਾਂ ਦੇ ਗਿਆ ਮਤਲਬ ਖਾਣਾ ਵਧੀਆ ਸੀਗਾ ਜੋ ਵੀ ਮੈਂ ਮੰਗਵਾਇਆ ਸੀ ਉਹ ਨੋ ਡਾਊਟ ਅੱਛਾ ਸੀ ਪਰ ਮੈਂ ਇੱਕ ਇਹਦੀ ਕੰਪਲੇਂਟ ਕਰਨੀ ਹੈ ਕਿ ਜਿਹੜਾ ਤੁਸੀਂ ਡਿਲੀਵਰੀ ਵਾਲਾ ਵਿਅਕਤੀ ਜੋ ਭੇਜਿਆ ਸੀਗਾ ਨਾ ਪਹਿਲੀ ਗੱਲ ਤਾਂ ਉਹਦਾ ਗੱਲ ਕਰਨ ਦਾ ਤਰੀਕਾ ਮੈਨੂੰ ਵਧੀਆ ਨਹੀਂ ਲੱਗਿਆ ਬਾਕੀ ਜਦੋਂ ਉਹ ਘਰ ਦੇ ਵਿੱਚ ਆਇਆ ਬੜੇ ਗੁੱਸੇ ਨਾਲ ਆਇਆ ਅਤੇ ਥੋੜ੍ਹਾ ਜਿਹਾ ਉਸਨੇ ਮੇਰੇ ਨਾਲ ਮਿਸਬਿਹੇਵ ਕਰਨ ਦੀ ਵੀ ਕੋਸ਼ਿਸ਼ ਕੀਤੀ ਮੀਨਸ ਕਿ ਜਦੋਂ ਮੈਂ ਉਹਨੂੰ ਮੈਨੂੰ ਲੱਗਿਆ ਉਹਦੀ ਸ਼ਕਲ ਦੇਖ ਕੇ ਕਿ ਜਦੋਂ ਮਤਲਬ ਉਹ ਟੱਚ ਕਰਨ ਦੀ ਕੋਸ਼ਿਸ਼ ਵੀ ਕਰਦਾ ਸੀਗਾ ਕੁਛ ਇਸ ਤਰ੍ਹਾਂ ਦਾ ਵੀ ਸ਼ਾਇਦ ਲੇਡੀ ਦੇਖ ਕੇ ਪਰ ਇਹਦੇ ਨਾਲ ਇਹ ਹੈ ਕਿ ਤੁਹਾਡਾ ਆਪਣਾ ਨਾਮ ਜਿਹੜਾ ਆ ਉਹ ਖਰਾਬ ਹੁੰਦਾ ਆ ਚਾਹੇ ਇੱਕ ਹੀ ਇਹੋ ਜਿਹਾ ਹੋਵੇ ਦੂਜੇ ਚੰਗੇ ਹੋਣ ਪਰ ਮੈਨੂੰ ਉਹਦਾ ਇਹ ਜਿਹੜਾ ਰਵੱਈਆ ਜਿਹੜਾ ਬਿਲਕੁਲ ਗਲਤ ਲੱਗਾ ਇੱਕ ਬੋਲਣ ਦਾ ਤਰੀਕਾ ਨਹੀਂ ਸੀ ਉਹਦਾ ਸਹੀ ਕਿਉਂਕਿ ਮੈਂ ਤਾਂ ਮੈਰਿਡ ਹਾਂ ਹੋ ਸਕਦਾ ਕਿ ਕੱਲ੍ਹ ਨੂੰ ਬੱਚੇ ਜਾਂ ਲੜਕੀਆਂ ਵੀ ਤੁਹਾਨੂੰ ਡਿਲੀਵਰੀ ਕਰਨ ਲਈ ਔਡਰ ਕਰਨ ਅਤੇ ਇਸ ਤਰ੍ਹਾਂ ਥੋੜ੍ਹਾ ਜਿਹਾ ਤੁਹਾਡਾ ਕੰਪਨੀ ਦਾ ਜਿਹੜਾ ਹੈ ਉਹ ਨੁਕਸਾਨ ਹੈ ਕਿ ਇਹ ਗੱਲ ਜਿਹੜੀ ਹੈ ਮੈਨੂੰ ਸਹੀ ਨਹੀਂ ਲੱਗੀ ਸੋ ਕਿਰਪਾ ਕਰਕੇ ਇਹੋ ਹੀ ਰਿਕੁਐਸਟ ਹੈ ਕਿ ਖਾਣਾ ਤੁਹਾਡਾ ਸਹੀ ਸੀ ਪਰ ਬੰਦਾ ਤੁਸੀਂ ਸਹੀ ਲਾਉ ਐਟਲੀਸਟ ਕਿ ਉਹਨੂੰ ਪਤਾ ਹੋਵੇ ਕਿ ਕਿਸ ਤਰ੍ਹਾਂ ਲੇਡੀ ਦੀ ਅਸੀਂ ਰਿਸਪੈਕਟ ਕਰਨੀ ਹੈ ਅਤੇ ਇਹ ਗੱਲ ਤਾਂ ਮੈਂ ਆਪਣੇ ਤੱਕ ਹੀ ਰੱਖੀ ਅਗਰ ਘਰ ਵੀ ਪਤਾ ਚੱਲਦੀ ਹੈ ਤਾਂ ਫਿਰ ਜ਼ਿਆਦਾ ਥੋੜ੍ਹਾ ਜਿਹਾ ਲੜਾਈ ਝਗੜੇ ਵਾਲਾ ਮਾਹੌਲ ਬਣਦਾ ਆ ਸੋ ਮੇਰੀ ਇਹ ਸ਼ਿਕਾਇਤ ਹੈ ਕਿ ਤੁਸੀਂ ਉਹਨੂੰ ਥੋੜ੍ਹਾ ਜਿਹਾ ਸਮਝਾਉ ਆਪਣੇ ਵਰਕਰਾਂ ਨੂੰ ਸੋ ਬਾਕੀ ਬਾਕੀ ਠੀਕ ਹੈ ਥੈਂਕ ਯੂ ਸੋ ਮਚ